ਹਾਂਜੀ ਕਈ ਕਾਰੋਬਾਰ ਇਦਾਂ ਦੇ ਹੁੰਦੇ ਹਨ ਜੋ ਕੀ ਵਾਤਾਵਰਨ ਨੂੰ ਧਨੁਸ਼ਟ ਕਰਦੇ ਹਨ ਵਾਤਾਵਰਨ ਆਲਾ ਦੁਆਲਾ ਆਪਾਂ ਨੂੰ ਸਾਫ ਸੁਥਰਾ ਰੱਖਣਾ ਚਾਹੀਦਾ ਹੈ ਵਾਤਾਵਰਨ ਖੁਸ਼ਹਾਲ ਰਹੇਗਾ ਤਾਂ ਹਰ ਇੱਕ ਪਰਸਨ ਦੀ ਜ਼ਿੰਦਗੀ ਖੁਸ਼ਹਾਲ ਰਹੇਗੀ ਵਾਤਾਵਰਨ ਨੂੰ ਸਾਨੂੰ ਦੂਸ਼ਿਤ ਹੋਣ ਤੋਂ ਰੋਕਣਾ ਚਾਹੀਦਾ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਈ ਫੈਕਟਰੀਸ ਹੁੰਦੀਆਂ ਨੇ ਫੈਕਟਰੀਸ ਦਾ ਗੰਦਾ ਪਾਣੀ ਜੋ ਕਿ ਸਾਫ ਪਾਣੀ ਦੇ ਵਿੱਚ ਜਾ ਕੇ ਉਸ ਨੂੰ ਖਰਾਬ ਕਰਦਾ ਤਾਂ ਜਿਹਨੂੰ ਆਪਾਂ ਕਹਿੰਦੇ ਹਾਂ ਪਾਣੀ ਦੂਸ਼ਿਤ ਹੋਣਾ ਵਾਤਾਵਰਨ ਦੇ ਵਿੱਚ ਸਾਫ ਸਫਾਈ ਰੱਖਣੀ ਬਹੁਤ ਹੀ ਮਹੱਤਵਪੂਰਨ ਰੱਖਦੀ ਹੈ ਤਾਂ ਇਸੇ ਤਰ੍ਹਾਂ ਸਾਨੂੰ ਪਾਣੀ ਨੂੰ ਸਾਫ ਰੱਖਣਾ ਚਾਹੀਦਾ ਹੈ ਕਈ ਵਾਰ ਫੈਕਟਰੀਆਂ ਦਾ ਗੰਦਾ ਧੂੰਆਂ ਗੰਦਾ ਪਾਣੀ ਔਰ ਕਚਰਾ ਪਾਣੀ ਵਿੱਚ ਸੁੱਟਿਆ ਜਾਂਦਾ ਹੈ ਤਾਂ ਸਾਨੂੰ ਉਸ ਨੂੰ ਰੋਕਣ ਲਈ ਬਹੁਤ ਹੀ ਠੋਸ ਕਦਮ ਚੁੱਕਣੇ ਚਾਹੀਦੇ ਹਨ ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਕਦਮਾਂ ਨੂੰ ਨੂੰ ਨਿਯੁਕਤ ਕੀਤਾ ਜਾਵੇ ਤਾਂ ਕਿ ਜੋ ਵੀ ਇੱਦਾਂ ਦੀ ਫੈਕਟਰੀ ਪਾਣੀ ਨੂੰ ਆਪਣੇ ਕਚਰਾ ਆਲੇ ਦੁਆਲੇ ਸੁੱਟਦੀ ਆ ਉਹ ਖੇਤਰ ਸਾਫ ਨੂੰ ਰੱਖਿਆ ਜਾਵੇ ਅਤੇ ਉਹ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਨੂੰ ਗੱਲਬਾਤ ਕੀਤੀ ਜਾਵੇ ਤਾਂ ਕਿ ਉਹ ਆਪਣੇ ਵਾਤਾਵਰਨ ਨੂੰ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਅਤੇ ਵਾਤਾਵਰਨ ਨੂੰ ਨੁਸ਼ ਨੁਕਸਾਨ ਨਾ ਪਹਿਚੋਣ ਸਕਣ